ਪੰਜਾਬੀ ਖੇਡਾਂ ਬਾਰੇ ਸਾਨੂੰ ਪਤਾ ਹੈ ਕਿ ਜਿਹੜੀਆਂ ਪੰਜਾਬੀ ਖੇਡਾਂ ਹਨ ਉਹ ਸਾਡੇ ਪੰਜਾਬ ਦਾ ਹਮੇਸ਼ਾ ਮਾਣ ਰਹੀਆਂ ਹਨ ਪੰਜਾਬ ਖੇਡਾਂ ਕਰਕੇ ਫੇਮਸ ਹੈ ਅਤੇ ਆਪਣੇ ਸੱਭਿਆਚਾਰਕ ਪਹਿਚਾਣ ਕਰਕੇ ਜਿਹੜਾ ਪੰਜਾਬ ਉਹ ਫੇਮਸ ਹੈ ਪੰਜਾਬ ਦੇ ਵਿੱਚ ਜਦੋਂ ਪਹਿਲੇ ਸਮੇਂ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਜਦੋਂ ਲੋਕ ਰਹਿੰਦੇ ਹੁੰਦੇ ਸਨ ਉਹਨਾਂ ਦਾ ਉਤਸ਼ਾਹ ਖੇਡਾਂ ਵੱਲ ਹੁੰਦਾ ਸੀ ਪੰਜਾਬ ਦੇ ਜਿਹੜੇ ਲੋਕ ਹੁੰਦੇ ਸਨ ਬਹੁਤ ਸਾਰੀਆਂ ਖੇਡਾਂ ਖੇਡਦੇ ਹੁੰਦੇ ਸਨ ਬਹੁਤ ਸਾਰੀਆਂ ਲੋਕ ਖੇਡਾਂ ਖੇਡਦੇ ਹੁੰਦੇ ਸਨ ਕਬੱਡੀ ਜਿਨ੍ਹਾਂ ਵਿੱਚੋਂ ਇੱਕ ਹੈ ਕਬੱਡੀ ਵਿੱਚ ਜੋ ਹੁੰਦਾ ਹੈ ਖਿਡਾਰੀ ਹੁੰਦੇ ਹਨ ਉਹ ਰੇਡ ਪਾਉਣ ਜਾਂਦੇ ਹਨ ਅਤੇ ਉਹ ਆਪਣੇ ਪੱਟ 'ਤੇ ਥਾਪੀ ਮਾਰਦੇ ਹਨ ਆਪਣੇ ਉਤਸ਼ਾਹ ਨੂੰ ਦ ਦਰਸਾਉਂਦੇ ਹਨ ਜਦੋਂ ਰੇਡ ਪਾ ਕੇ ਇੱਕ ਪੁਆਇੰਟ ਲੈ ਕੇ ਜਿੱਥੇ ਕਿ ਆਪਣੀ ਹੱਦ ਵਿੱਚ ਵਾਪਿਸ ਆਉਂਦੇ ਹਨ ਤਾਂ ਉਹ ਥਾਪੀ ਮਾਰ ਕੇ ਆਪੇ ਉਤਸ਼ਾਹ ਨੂੰ ਦਰਸਾਉਂਦੇ ਹਨ ਇਸ ਤਰ੍ਹਾਂ ਜਿਹੜੀ ਕਿ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦਾ ਰਿਹਾ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਕੋਈ ਵੀ ਲੜਾਈ ਕਰਨ ਲਈ ਲੰਘਦਾ ਸੀ ਸਭ ਤੋਂ ਪਹਿਲਾਂ ਉਸਨੂੰ ਪੰਜਾਬ ਵਿੱਚੋਂ ਹੀ ਲੰਘਣਾ ਪੈਂਦਾ ਸੀ ਕਿਉਂਕਿ ਪੰਜਾਬ ਜੋ ਹੈ ਉਹ ਸਾਡਾ ਇੱਕ ਮੇਨ ਦੁਆਰ ਸੀ ਤੋ ਇਸ ਕਰਕੇ ਜਦੋਂ ਪੰਜਾਬ ਦੇ ਵਿੱਚੋਂ ਲੋਕ ਲੰਘਦੇ ਸਨ ਤਾਂ ਇਸ ਕਰਕੇ ਉਹਨਾਂ ਦੇ ਪੰਜਾਬੀ ਲੋਕ ਹੇ ਦੇਖਦੇ ਦੇਖਦੇ ਅਣਖੀ ਬਣਦੇ ਗਏ ਕਹਿਣ ਦਾ ਮਤਲਬ ਹੈ ਕਿ ਪੰਜਾਬੀ ਲੋਕ ਲੜਾਈ ਕਰਨ ਨੂੰ ਹਮੇਸ਼ਾ ਤੇਜ਼ ਹੁੰਦੇ ਗਏ ਕਿਉਂਕਿ ਉਹਨਾਂ ਅੰਦਰ ਇੱਕ ਉਤਸ਼ਾਹ ਭਰਦਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੋਂ ਜਿਹੜੇ ਕਿ ਬਹੁਤ ਸਾਰੇ ਲੋਕ ਲੰਘਦੇ ਹਨ ਅਤੇ ਜਿਸ ਕਰਕੇ ਜਿਹੜੀ ਕਬੱਡੀ ਖੇਡ ਹੈ ਉਹ ਇਸ ਤਰ੍ਹਾਂ ਉਤਸ਼ਾਹ ਨੂੰ ਇੱਕ ਪੇਸ਼ ਕਰਦੀ ਹੈ ਹੋਰ ਵੀ ਬਹੁਤ ਸਾਰੀਆਂ ਜੋ ਬਲਦ ਦੌੜਾਂ ਹਨ ਹੋਰ ਵੀ ਐਸੇ ਜਿਹੜੀਆਂ ਖੇਡਾਂ ਹਨ ਜਿਹੜੀਆਂ ਕਿ ਪੰਜਾਬ ਵਿੱਚ ਹੁੰਦੀਆਂ ਹਨ ਉਹ ਸਾਡੀ ਇੱਕ ਸੱਭਿਆਚਾਰਕ ਪਹਿਚਾਣ ਨੂੰ ਬਚਾਉਣ ਨੂੰ ਉਤਸ਼ਾਹਿਤ ਰਵੱਈਆ ਦਿੰਦੀਆਂ ਹਨ ਅਤੇ ਜਿਹੜੀਆਂ ਖੇਡਾਂ ਆ ਉਹ ਸਾਡੇ ਪੰਜਾਬ ਵਿੱਚ ਇੱਕ ਬਹੁਤ ਹੀ ਵਧੀਆ ਭੂਮਿਕਾ ਨਿਭਾਉਂਦੀਆਂ